ਹਾਂਜੀ ਹੁਣ ਅਸੀਂ ਵੀ ਪਾਣੀ ਦੀ ਸਪਲਾਈ ਲੈ ਰਹੇ ਹਾਂ ਕੁਛ ਕੁ ਮਹੀਨਿਆਂ ਤੋਂ ਇਸ ਤੋਂ ਪਹਿਲਾਂ ਤਾਂ ਅਸੀਂ ਨਲਕੇ ਦਾ ਪਾਣੀ ਬੋਰ ਦਾ ਹੀ ਯੂਜ ਕਰਦੇ ਸੀ ਜਿਹਦੇ ਨਾਲ ਟਾਈਮ ਪੈ ਕੇ ਕਾਫੀ ਦਿੱਕਤਾਂ ਆਉਣੀਆਂ ਸਟਾਰਟ ਹੋ ਗਈਆਂ ਸੀ ਜਿਵੇਂ ਪਾਣੀ ਖਾਰਾ ਹੋ ਗਿਆ ਸੀ ਕੱਪੜੇ ਵਗੈਰਾ ਸਾਫ਼ ਨਹੀਂ ਹੋ ਰਹੇ ਸੀ ਨੀਲ ਵਗੈਰਾ ਲਗਾਉਂਦੇ ਸੀ ਤਾਂ ਉਹ ਵੀ ਜੰਮ ਰਿਹਾ ਸੀ ਅਤੇ ਇਸ ਲਈ ਅਸੀਂ ਵੀ ਪਾਣੀ ਦੀ ਸਪਲਾਈ ਲਈ ਜਦੋਂ ਤੋਂ ਅਸੀਂ ਇਹ ਸਪਲਾਈ ਲਈ ਤਾਂ ਉਦੋਂ ਤੋਂ ਇਹ ਸਾਰੀਆਂ ਦਿੱਕਤਾਂ ਸੋਲਵ ਹੋ ਗਈਆਂ ਸਾਡੇ ਜਿਵੇਂ ਹੁਣ ਕੱਪੜਿਆਂ ਸਾਬਣ ਵਗੈਰਾ ਫਟਦੀ ਨਹੀਂ ਜਾਂ ਕੱਪੜਿਆਂ ਨੂੰ ਜਦੋਂ ਆਪਾਂ ਨੀਲ ਵਗੈਰਾ ਲਗਾਉਂਦੇ ਹਾਂ ਵਾਈਟ ਨੂੰ ਤਾਂ ਉਹ ਵੀ ਜੰਮਦਾ ਨਹੀਂ ਹੈ ਅਤੇ ਜਿਹੜਾ ਫਰਸ਼ 'ਤੇ ਵੀ ਜਦੋਂ ਵੀ ਅਸੀਂ ਨਹਾਉਂਦੇ ਵਗੈਰਾ ਸੀ ਜ ਤਾਂ ਉਹ ਸਾਬਣ ਵਗੈਰਾ ਸਾਰਾ ਉਵੇਂ ਹੀ ਜੰਮ ਜਾਂਦਾ ਸੀ ਫਟ ਫਟ ਕੇ ਅਤੇ ਪੂਰੇ ਗੰਦਗੀ ਜਿਸ ਪੂਰੇ ਘਰ 'ਚ ਰਹਿੰਦੀ ਸੀ ਪੀਣ ਦੇ ਪਾਣੀ ਲਈ ਵੀ ਕਾਫੀ ਦਿੱਕਤਾਂ ਆ ਰਹੀਆਂ ਸੀ ਜਿਵੇਂ ਖਾਰਾ ਹੋ ਗਿਆ ਸੀ ਨਮਕ ਵਾਲਾ ਹੁਣ ਇਹ ਜਦੋਂ ਤੋਂ ਅਸੀਂ ਪਾਣੀ ਲੈਣ ਲੱਗੇ ਤਾਂ ਸਾਡੀਆਂ ਇਹ ਵੀ ਦਿੱਕਤਾਂ ਜੋ ਸੋਲਵ ਹੋ ਗਈਆਂ ਹੁਣ ਸਫਾਈ ਸਫੂਈ ਕਰਦੇ ਹਾਂ ਤਾਂ ਬਿਲਕੁਲ ਸਾਰਾ ਬਰਤਨ ਵਗੈਰਾ ਦੀ ਸਾਰਿਆਂ ਦੀ ਸਾਈਨਿੰਗ ਅਲੱਗ ਹੀ ਲੁੱਕ ਆ ਰਹੀ ਆ ਅਤੇ ਬਾਕੀ ਦੇਖੋ ਹੁਣ ਜਿਹੜਾ ਇਹ ਆਪਾਂ ਪਾਣੀ ਜਿਹੜਾ ਲਗਾ ਲੈਂਦੇ ਹਾਂ ਉਹ ਦੋ ਤਿੰਨ ਘੰਟੇ ਤੱਕ ਚੱਲਦਾ ਰਹਿੰਦਾ ਹੈ ਤਾਂ ਸਾਨੂੰ ਇਹ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਵੀ ਪਾਣੀ ਉਹ ਜੇ ਇਹ ਨਹੀਂ ਆ ਵੀ ਜੇ ਪਾਣੀ ਆ ਰਿਹਾ ਆਪਣਾ ਕਿਹੜਾ ਉਹਦੇ 'ਚ ਕੁਛ ਲੱਗ ਰਿਹਾ ਤਾਂ ਵੀ ਚੱਲਦਾ ਹੀ ਰਹਿਣ ਦਿਓ ਜਾਂ ਡੁੱਲੀ ਜਾਣ ਦਿਓ ਆਪਾਂ ਉਹ ਵੀ ਧਿਆਨ ਰੱਖਣਾ ਵੀ ਆਪਣੇ ਬੱਚਿਆਂ ਨੂੰ ਵੀ ਉਸ ਬਾਰੇ ਦੱਸਣਾ ਵੀ ਜਿੰਨਾ ਜ਼ਰੂਰਤ ਹੈ ਉਨਾ ਪਾਣੀ ਯੂਜ਼ ਕਰੋ ਜਾਂ ਉਹਨੂੰ ਬਾਕੀ ਟੈਪ ਨੂੰ ਉਨਾ ਬੰਦ ਕਰ ਦਿਓ ਵੀ ਇਹ ਨਹੀਂ ਆ ਕਈ ਜਗ੍ਹਾ 'ਤੇ ਅਸੀਂ ਦੇਖਿਆ ਵੀ ਵਾਟਰ ਵਰਕਸ ਦਾ ਪਾਣੀ ਆ ਰਿਹਾ ਤਿੰਨ ਤਿੰਨ ਚਾਰ ਚਾਰ ਘੰਟੇ ਚੱਲ ਰਿਹਾ ਤਾਂ ਉਹ ਲਗਾਤਾਰ ਉਹਨਾਂ ਨੇ ਪਾਈਪ ਸਿੱਧੀ ਲਗਾ ਰੱਖੀ ਹੁੰਦੀ ਹੈ ਉਹ ਕਦੇ ਚੈਬਰਾਂ 'ਚ ਕਿਤੇ ਵੀ ਪਾਣੀ ਸਿੱਧਾ ਡਾਇਰੈਕਟ ਇਸ ਤਰ੍ਹਾਂ ਹੀ ਜਾ ਰਿਹਾ ਸਾਫ਼ ਪਾਣੀ ਹੁੰਦਾ ਕੋਈ ਉਹਦੀ ਯੂਜ਼ੇਬਲ ਨਹੀਂ ਹੋ ਰਹੀ ਹੁੰਦੀ ਯੂਜ਼ ਅਤੇ ਇਸ ਕਰਕੇ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਨਾਲ ਨਾਲ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਸਿਖਾਉਣਾ ਚਾਹੀਦਾ ਵੀ ਕਿਉਂਕਿ ਪਾਣੀ ਹੁਣ ਦਿਨੋ ਦਿਨ ਘੱਟ ਹੋ ਰਿਹਾ ਆਪਣੇ ਨੀਚੇ ਜਿੰਨਾ ਹੀ ਪਾਣੀ ਡਾਊਨ ਜਾ ਰਿਹਾ ਤਾਂ ਇਸ ਕਰਕੇ ਆਪਾਂ ਨੂੰ ਪਾਣੀ ਦੀ ਵੀ ਬੱਚਤ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਇਸ ਚੀਜ਼ ਬਾਰੇ ਸਿਖਾਉਣਾ ਚਾਹੀਦਾ ਕਿਉਂਕਿ ਲਾਈਫ 'ਚ ਜਾ ਕੇ ਅੱਗੇ ਆਪਾਂ ਨੂੰ ਵੀ ਜੋ ਵੀ ਕੋਈ ਦਿੱਕਤਾਂ ਹੈ ਵੀ ਪਾਣੀ ਸੰਬੰਧੀ ਉਹਨਾਂ ਦਾ ਨਾ ਸਾਹਮਣਾ ਕਰਨਾ ਪਵੇ ਕਿਉਂਕਿ ਪਾਣੀ ਆਪਣੇ ਜੀਵਨ ਦਾ ਸਭ ਤੋਂ ਜ਼ਰੂਰੀ ਪਾਰਟ ਹੈ ਇਹਦੇ ਬਿਨਾਂ ਆਪਾਂ ਬਿਲਕੁਲ ਨਹੀਂ ਰਹਿ ਸਕਦੇ ਨਾ ਤਾਂ ਆਪਾਂ ਨਹਾਏ ਬਿਨਾਂ ਰਹਿ ਸਕਦੇ ਹਾਂ ਨਾ ਆਪਾਂ ਪੀਏ ਬਿਨਾਂ ਪਾਣੀ ਰਹਿ ਸਕਦੇ ਹੈ ਅਤੇ ਨਾ ਹੀ ਆਪਾਂ ਕਾਸੇ ਬਿਨਾਂ ਯੂਜ਼ ਕਰ ਸਕਦੇ ਹੈ ਸੋ ਓਕੇ